ਤੇਰ੍ਹਾਂ ਇੱਕ ਸੌ ਚੌਂਤੀ ਪੰਜ ਹਜ਼ਾਰ ਪੰਜ ਸੌ ਛਿਆਲੀ ਅਠਤਾਲੀ ਹਜ਼ਾਰ ਇੱਕ ਸੌ ਬੱਤੀ ਇੱਕ ਲੱਖ ਅੱਠ ਹਜ਼ਾਰ ਸੱਤ ਸੌ ਇਕਹੱਤਰ